ਮੀਡੀਆ ਜਿਵੇਂ ਕਿ ਰੇਡੀਓ ਟੈਲੀਵਿਜ਼ਨ ਔਰ ਪਿੰਡ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਅਨੇਕਾਂ ਤਰ੍ਹਾਂ ਕੀਤੀ ਜਾਂਦੀ ਹੈ ਜਿਵੇਂ ਕਿ ਪੰਜਾਬੀ ਗੀਤਾਂ ਰਾਹੀਂ ਪੰਜਾਬੀ ਪ੍ਰੋਗਰਾਮਾਂ ਰਾਹੀਂ ਗੱਲਬਾਤ ਅਤੇ ਵਿਚਾਰਾਂ ਰਾਹੀਂ ਔਰ ਕਵਿਤਾ ਦੁਆਰਾ ਕੋਈ ਗੱਲਬਾਤ ਕੋਈ ਇੱਕ ਵਿਸ਼ੇ ਦੇ ਉੱਤੇ ਗੱਲਬਾਤ ਕਰਕੇ ਇਹਨਾਂ ਰਾਹੀਂ ਪੰਜਾਬੀ ਦੀ ਵਰਤੋਂ ਕੀਤੀ ਜਾਂਦੀ ਹੈ ਪ੍ਰਿੰਟਿੰਗ ਵਿੱਚ ਪੰਜਾਬੀ ਦੀਆਂ ਕਵਿਤਾਵਾਂ ਖਬਰਾਂ ਗੱਲਬਾਤ ਦਾ ਵਿਸ਼ਾ ਕੋਈ ਇੱਕ ਵਿਸ਼ੇ ਦੇ ਉੱਤੇ ਜਾਣਕਾਰੀ ਦਿੱਤੀ ਜਾਂਦੀ ਹੈ